ਉਨੱਤੀ ਨਵੰਬਰ ਉੱਨੀ ਸੌ ਬਾਨਵੇਂ ਦਸ ਅਕਤੂਬਰ ਉੱਨੀ ਸੌ ਨੜ੍ਹਿਨਵੇਂ ਦੋ ਅਗਸਤ ਦੋ ਹਜਾਰ ਛੇ ਬਾਰਾਂ ਦਸੰਬਰ ਦੋ ਹਜਾਰ ਤੇਰ੍ਹਾਂ ਚੌਦਾਂ ਜਨਵਰੀ ਦੋ ਹਜਾਰ ਚੌਵੀ